ਹਾਂਜੀ ਸਰ ਮੇਰਾ ਨਾ ਤੁਹਾਡੇ ਬੈਂਕ ਦੇ ਵਿੱਚ ਅਕਾਊਂਟ ਹੈ ਜੋ ਕਿ ਮੈਂ ਬੰਦ ਕਰਵਾਉਣਾ ਚਾਹੁੰਦੀ ਹਾਂ ਜੀ ਮੇਰਾ ਨਾਮ ਆਂਚਲ ਹੈ ਹਾਂਜੀ ਹਾਂਜੀ ਮੇਰਾ ਨਾਇਨ ਫਾਇਵ ਨਾਇਨ ਟੂ ਥ੍ਰੀ ਸੈਵਨ ਜ਼ੀਰੋ ਫਾਇਵ ਥ੍ਰੀ ਸੈਵਨ ਹਾਂਜੀ ਇਸੇ ਨੰਬਰ 'ਤੇ ਹੈ ਹਾਂਜੀ ਮੇਰੀ ਡੇਟ ਔਫ ਬਰਥ ਹੈ ਟਵੈਂਟੀ ਵਨ ਅਕਤੂਬਰ ਹਾਂਜੀ ਨਾਇਨਟੀ ਨਾਇਨਟੀ ਫੋਰ ਹਾਂਜੀ ਹਾਂਜੀ ਐਕਚੁਲੀ ਮੇਰੀ ਨਾ ਹੁਣੇ ਲਾਸਟ ਮੰਥ ਹੀ ਮੈਰੀਜ ਹੋਈ ਹੈ ਅਤੇ ਮੈਂ ਹੁਣ ਦੂਸਰੀ ਸਿਟੀ ਜੋ ਆ ਮ ਜਗ੍ਹਾ ਸ਼ਿਫਟ ਹੋ ਚੁੱਕੀ ਹਾਂ ਅਤੇ ਇਸ ਕਰਕੇ ਮੈਂ ਆਪਣਾ ਅਕਾਊਂਟ ਹੁਣ ਉੱਥੇ ਖੁੱਲ੍ਹਵਾ ਰਹੀ ਹਾਂ ਅਤੇ ਮੈਂ ਇਹ ਆ ਮੇਰਾ ਪੁਰਾਣਾ ਅਕਾਊਂਟ ਜੋ ਹੈ ਕਿ ਬੰਦ ਕਰਵਾਉਣਾ ਚਾਹ ਰਹੀ ਹਾਂ ਨਜ਼ਦੀਕੀ ਨਹੀਂ ਉੱਥੇ ਮੇਰੇ ਹਸਬੈਂਡ ਔਲਰੇਡੀ ਨਵਾਂ ਅਕਾਊਂਟ ਜੋ ਹੈ ਹੋਰ ਬੈਂਕ ਦੇ ਵਿੱਚ ਖੁੱਲ੍ਹਵਾ ਚੁੱਕੇ ਨੇ ਅਤੇ ਫਿਰ ਮੈਂ ਦੋ ਦੋ ਬੈਂਕ ਅਕਾਊਂਟ ਨਹੀਂ ਓਪਨ ਰੱਖਣਾ ਚਾਹੁੰਦੀ ਅੱਛਾ ਜੀ ਅਤੇ ਇਹਦੇ ਲਈ ਕੀ ਕੀ ਡਾਕੂਮੈਂਟਸ ਲੱਗਣਗੇ ਹਾਂਜੀ ਅੱਛਾ ਜੀ ਅਤੇ ਹੋਰ ਸਰ ਬਸ ਇਹ ਚੀਜ਼ਾਂ ਨਾਲ ਮੇਰਾ ਬੈਂਕ ਅਕਾਊਂਟ ਬੰਦ ਹੋ ਜਾਵੇਗਾ ਅਤੇ ਕਿੰਨੇ ਦਿਨਾਂ ਵਿੱਚ ਬੰਦ ਹੋ ਜਾਵੇਗਾ ਅੱਛਾ ਜੀ ਹੋਰ ਕੋਈ ਚੀਜ਼ ਦੀ ਜ਼ਰੂਰਤ ਤਾਂ ਨਹੀਂ ਕੋਈ ਹੋਰ ਡੋਕਿਊਮੈਂਟ ਕੋਈ ਠੀਕ ਹੈ ਜੀ ਚਲੋ ਠੀਕ ਹੈ ਥੈਂਕ ਯੂ ਸਰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਠੀਕ